ਹੈਲੋ ਜੀ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਭਾਅ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਬਸ ਕੁਛ ਨਹੀਂ ਜੀ ਮੈਂ ਕਿਹਾ ਤੁਹਾਡਾ ਨੰਬਰ ਮਿਲਿਆ ਸੀਗਾ ਅਮਨ ਤੋਂ ਉਹ ਮੈਂ ਕਿਹਾ ਸਬਜ਼ੀਆਂ ਜਿਹੀਆਂ ਲੈਣੀਆਂ ਸੀ ਕੁੜੀ ਦਾ ਵਿਆਹ ਆ ਗਿਆ ਆਪਣੀ ਦਾ ਹਾਂ ਮੈਂ ਕਿਹਾ ਆਪਾਂ ਭਾਅ ਜੀ ਨੂੰ ਯਾਦ ਕਰਦੇ ਹਾਂ ਵੀ ਆਪਣੇ ਕੋਲ ਔਰਗੈਨਿਕ ਸਬਜ਼ੀਆਂ ਵਾਲਾ ਹੈਗਾ ਬੰਦਾ ਕਾਹਨੂੰ ਆਪਾਂ ਇੱਧਰ ਉੱਧਰ ਧੱਕੇ ਖਾਣੇ ਕਿਤੇ ਹਾਂਜੀ ਆਹ ਦੱਸਿਓ ਗੋਭੀ ਦਾ ਕਿਆ ਰੇਟ ਚੱਲਦਾ ਜੀ

ਅੱਛਾ ਜੀ ਅਤੇ ਆਪਾਂ ਨੂੰ ਕਿਆ ਰੇਟ ਲੱਗੂਗਾ ਭਾਅ ਜੀ ਆਪਾਂ ਪੰਜਾਹ ਕਿੱਲੋ ਲੈਣੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਅਤੇ ਆਪਾਂ ਸ਼ਿਮਲਾ ਮਿਰਚ ਵੀ ਲੈਣੀ ਹੈ ਭਾਅ ਜੀ

ਅੱਛਾ ਅੱਛਾ ਆਪਾਂ ਲੈਣੀ ਪਰ ਜ਼ਿਆਦਾ ਉਹ ਆਪਾਂ ਪਕੌ ਹਾਂਜੀ ਹਾਂ ਆਪਾਂ ਪਕੌੜੇ ਵੀ ਕੱਢਣੇ ਨਾ ਸ਼ਿਮਲਾ ਮਿਰਚ ਵਾਲੇ ਹਾਂਜੀ ਹਾਂ ਅਤੇ ਆਪਣੇ ਕੋਲ ਆਹ ਸਲਾਦ ਵਾਸਤੇ ਕਿਆ ਕਿਆ ਜੀ ਆਪਣੇ ਕੋਲ

ਅੱਛਾ ਜੀ ਠੀਕ ਹੈ ਠੀਕ ਹੈ ਇਹ ਆਪਣੇ ਕੋਲ ਚੁਕੰਦਰ ਨਹੀਂ ਹੁੰਦੀ ਫਿਰ

ਤੇ ਆਹ ਆਪਾਂ ਨੂੰ ਮੂਲੀ ਕਿਆ ਰੇਟ ਪਊਗੀ ਅੱਛਾ ਖੀਰਾ ਚੱਲੋ ਠੀਕ ਹੈ ਠੀਕ ਹੈ ਫਿਰ ਇੱਦਾਂ ਕਰਦੇ ਹਾਂ ਆਪਾਂ ਮੈਂ ਪਰਸੋਂ ਨੂੰ ਆਉਂਦਾ ਫਿਰ ਸਾਰੀ ਲਿਸਟ ਲੈ ਕੇ ਜਿਹੜੀ ਹਲਵਾਈ ਨੇ ਦੇਈ ਆ ਮੈਨੂੰ ਬਸ ਠੀਕ ਹੈ ਜੀ ਠੀਕ ਹੈ ਮੈਂ ਆਉਣਾ ਫਿਰ ਪਰਸੋਂ ਨੂੰ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਠੀਕ ਹੈ ਜੀ ਠੀਕ ਹੈ ਓਕੇ